ਮਨੋਰੰਜਨ ਉਦਯੋਗ ਦੇ ਵਿੱਚ ਖੇਡਾਂ ਦੇ ਵਿੱਚ ਕ੍ਰਿਕਟ ਦਾ ਬਹੁਤ ਬੜਾ ਮਹੱਤਵ ਹੈ ਕ੍ਰਿਕਟ ਦਾ ਖੇਡ ਜਿਹੜਾ ਹੈ ਬਹੁਤ ਹੀ ਉਤਸ਼ਾਹ ਨਾਲ ਦੇਖਿਆ ਜਾਂਦਾ ਹੈ ਤੁਸੀਂ ਦੇਖਦੇ ਹੋ ਕਿ ਲੋਕੀਂ ਸਾਡੇ ਮੁਲਕ ਸਭ ਤੋਂ ਜ਼ਿਆਦਾ ਲੋਕੀਂ ਕ੍ਰਿਕਟ ਦੇਖਦੇ ਹਨ ਉਹ ਕ੍ਰਿਕਟ ਦਾ ਮਨੋਰੰਜਨ ਕਰਦੇ ਹਨ ਅਕਸਰ ਹੀ ਤੁਸੀਂ ਦੇਖਦੇ ਹੋ ਘਰਾਂ ਦੇ ਵਿੱਚ ਲੋਕੀਂ ਕ੍ਰਿਕਟ ਦੇਖਣ ਲਈ ਆਪਣੇ ਸਭ ਰਿਸ਼ਤੇਦਾਰਾਂ ਨੂੰ ਬੁਲਾ ਕੇ ਆਪ 'ਚ ਇਕੱਠੇ ਬਹਿ ਕੇ ਕ੍ਰਿਕਟ ਖੇ ਦੇਖਦੇ ਹਨ ਕ੍ਰਿਕਟ ਦੇ ਦੇਖਦੇ ਦੇਖਦੇ ਨਾਲ ਖਾਣ ਪੀਣ ਦਾ ਵੀ ਪ੍ਰੋਗਰਾਮ ਬਣਾ ਲੈਂਦੇ ਹਨ ਅਕਸਰ ਤੁਸੀਂ ਦੇਖਦੇ ਹੋ ਕਿ ਜਦੋਂ ਕੋਈ ਵੱਡਾ ਕੋਈ ਟੂਰਨਾਮੈਂਟ ਹੁੰਦਾ ਹੈ ਤਾਂ ਉਹ ਟੂਰਨਾਮੈਂਟ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਵੱਡੀਆਂ ਵੱਡੀਆਂ ਸਕਰੀਨਾਂ ਲਗਾਈਆਂ ਜਾਂਦੀਆਂ ਹਨ ਔਰ ਲੋਕੀਂ ਇਕੱਠੇ ਬੈਠ ਕੇ ਬਜ਼ਾਰਾਂ ਦੇ ਵਿੱਚ ਮੈਚ ਦੇਖਦੇ ਹਨ ਔਰ ਵਰਲਡ ਕੱਪ ਦਾ ਟੂਰਨਾਮੈਂਟ ਜਿਹੜਾ ਇੰਡੀਆ ਦੇ ਵਿੱਚ ਬੜੇ ਉਤਸ਼ਾਹ ਨਾਲ ਖੇਡਿਆ ਜਾਂਦਾ ਹੈ ਉਹਦੇ ਵਿੱਚ ਲੋਕਾਂ ਦਾ ਬੜਾ ਉਤਸ਼ਾਹ ਦਿਖਾਇਆ ਜਾਂਦਾ ਹੈ ਮੈਚ ਜਿਹਦੇ ਬੜੇ ਹੀ ਹਾਈਲਾਈਟ ਕੀਤੇ ਜਾਂਦੇ ਹਨ ਮੈਚਾਂ ਨੂੰ ਦੇਖਣ ਵਾਸਤੇ ਲੋਕੀਂ ਬਾਹਰ ਜਾ ਕੇ ਵੀ ਕਹਿੰਦੇ ਆ ਹੋਟਲਾਂ ਦੇ ਵਿੱਚ ਜੋ ਸਕਰੀਨਾਂ ਵਗੈਰਾ ਬੁੱਕ ਕਰਵਾ ਲੈਂਦੇ ਹਨ ਮੈਚ ਦੇਖਦੇ ਹਨ